ਹਾਂਜੀ ਤੈਕਨੋਲਜੀ ਦੇ ਬੁਨਿਆਦੀ ਰੂਪ ਆਪਣੇ ਆਲੇ ਦੁਆਲੇ ਦੇਖਣ ਨੂੰ ਬਹੁਤ ਸਾਰੇ ਹਨ ਛੋਟੀ ਤੋਂ ਛੋਟੀ ਜਿਹੜੀ ਚੀਜ਼ ਦੇ ਵਿੱਚ ਤੈਕਨੋਲੋਜੀ ਦੇ ਇੱਕ ਜਾ ਸਕਦੀ ਹੈ ਜਿਵੇਂ ਕਿ ਆਪਣੇ ਡੇਲੀ ਜੀਵਨ ਦੇ ਵਿੱਚ ਆਪਾਂ ਡੇਲੀ ਰੂਟੀਨ ਦੇ ਮੋਬਾਇਲ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਮੋਬਾਇਲ ਨੇ ਕੀ ਆ ਸਾਰੀ ਦੁਨੀਆ ਨੂੰ ਇੱਕ ਮੁੱਠੀ ਦੇ ਵਿੱਚ ਕਰ ਦਿੱਤਾ ਹੈਗਾ ਕਿ ਅਸੀਂ ਕੋਈ ਵੀ ਕੰਮ ਕਰਨਾ ਹੈਗਾ ਮਿਨਜ ਸਾਨੂੰ ਬੈਂਕ ਜਾਣ ਦੀ ਵੀ ਜ਼ਰੂਰਤ ਨਹੀਂ ਜਸਟ ਉੱਥੋਂ ਹੀ ਅਸੀਂ ਪੈਸੇ ਵਿਦਡਰਆ ਜਾਂ ਜੋ ਵੀ ਕੁਛ ਕਰਨਾ ਐਟ ਏ ਟਾਈਮ ਹੀ ਕਰ ਸਕਦੇ ਹਾਂ ਪੈਸਿਆ ਵਾਲੀ ਸਾਰੀ ਦਿੱਕਤ ਸਾਨੂੰ ਖਤਮ ਹੋ ਗਈ ਕੋਈ ਵੀ ਚੀਜ਼ ਅਸੀਂ ਆਨਲਾਈਨ ਖਰੀਦਣੀ ਹੈ ਤਾਂ ਸਾਨੂੰ ਕਿਸੇ ਵੀ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਨਹੀਂ ਘਰ ਬੈਠੇ ਹੀ ਅਸੀਂ ਆਪਣੀ ਆਨਲਾਈਨ ਸ਼ੋਪਿੰਗ ਕਰ ਸਕਦੇ ਹਾਂ ਪਹਿਲਾਂ ਅਸੀਂ ਬਿਜਲੀ ਦਾ ਬਿੱਲ ਹੋ ਗਿਆ ਹੋਰ ਨਿੱਕੇ ਮੋਟੇ ਬਿੱਲ ਭਰਨ ਦੇ ਲਈ ਛੁੱਟੀ ਲੈਂਦੇ ਜਾਂ ਕੁਝ ਹੋਰ ਕਰਦੇ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਆਸਾਨ ਬਣਾ ਦਿੱਤਾ ਗਿਆ ਹੈਗਾ ਇਸ ਟੈਕਨੋਲਜੀ ਦੇ ਛੋਟੇ ਜਿਹੇ ਰੂਪ ਮੋਬਾਇਲ ਫੋਨ ਨੇ ਤਾਂ ਅਸੀਂ ਘਰ ਬੈਠੇ ਹੀ ਆਪਣੇ ਬਿੱਲ ਦਾ ਭੁਗਤਾਨ ਬਹੁਤ ਜਲਦੀ ਕਰ ਸਕਦੇ ਹਾਂ ਇਸ ਤੋਂ ਇਲਾਵਾ ਇੱਕ ਹੋਊਗਾ ਜਿਵੇਂ ਆਪਣੇ ਕਰੋਨਾ ਟਾਈਮ ਸੀਗਾ ਜੇ ਮੋਬਾਇਲ ਨਾ ਹੁੰਦੇ ਤਾਂ ਵਿਦਿਆਰਥੀ ਜਿਹੜੇ ਆਪਣੀ ਸਿੱਖਿਆ ਤੋਂ ਵਾਂਝੇ ਵੀ ਰਹਿ ਸਕਦੇ ਸੀ ਤਾਂ ਉਹਦੇ ਲਈ ਜੂਮ ਮੀਟਿੰਗ ਜਾਂ ਹੋਰ ਕਈ ਜਿਹੜੇ ਇੱਦਾਂ ਦੇ ਸਾਧਨ ਅਪਣਾਏ ਗਏ ਜਿਹਦੇ ਨਾਲ ਵਿਦਿਆਰਥੀਆਂ ਦੀ ਆਨਲਾਈਨ ਕਲਾਸਾਂ ਦਾ ਜਿਹੜਾ ਕੀ ਹੈ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਕਈ ਯੂਟੂਬ ਦੇ ਉੱਪਰ ਇੰਨੇ ਵਧੀਆ ਲੈਸਨ ਹੁੰਦੇ ਨੇ ਵਿਦਿਆਰਥੀਆਂ ਲਈ ਲਾਹੇਵੰਦ ਹੁੰਦੇ ਨੇ ਅਤੇ ਉਹ ਜਿਹੜਾ ਕੀ ਹੈ ਕਈ ਵਾਰ ਤਾਂ ਇਹਦਾ ਬੱਚਾ ਸਹੀ ਉਪਯੋਗ ਕਰਦਾ ਪਰ ਕਈ ਬੱਚੇ ਦੁਰਉਪਯੋਗ ਵੀ ਕਰਦੇ ਨੇ ਤਾਂ ਉਹਨੂੰ ਜਿਹੜਾ ਸਹੀ ਉਪਯੋਗ ਦੇ ਵਿੱਚ ਇਹਨਾਂ ਨੂੰ ਲਿਆਉਣਾ ਚਾਹੀਦਾ ਤੈਕਨੋਲਜੀ ਨੂੰ ਤੈਕਨੋਲਜੀ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਆਸਾਨ ਬਣਾ ਦਿੱਤਾ ਹੈ ਜਿਵੇਂ ਕਿ ਹੁਣ ਹਰ ਇੱਕ ਘਰ ਦੇ ਵਿੱਚ ਕਿੰਨੇ ਜ਼ਿਆਦਾ ਵਹੀਕਲ ਨੇ ਅੱਗੇ ਲੋਕ ਪੈਦਲ ਜਾਂਦੇ ਸਾਈਕਲ 'ਤੇ ਜਾਂਦੇ ਰਿਹੜੀਆਂ ਵਗੈਰਾ ਗੱਡੀਆਂ 'ਤੇ ਜਾਂਦੇ ਅਤੇ ਹੁਣ ਹਰ ਇੱਕ ਦੇ ਘਰ ਨਵੀਆਂ ਤੋਂ ਨਵੀਆਂ ਕਾਰਾਂ ਦੀਆਂ ਸਹੂਲਤਾਂ ਜਿਹੜੀਆਂ ਪ੍ਰਦਾਨ ਹੋ ਗਈਆਂ ਨੇ ਇਸ ਤੋਂ ਇਲਾਵਾ ਹਰ ਇੱਕ ਚੀਜ਼ ਤੈਕਨੋਲਜੀ ਦੇ ਨਾਲ ਭਰੀ ਪਈ ਹੈ ਵਾਸ਼ਿੰਗ ਮਸ਼ੀਨ ਹਰ ਇੱਕ ਘਰ ਠੰਢਾ ਪਾਣੀ ਪੀਣ ਦੇ ਲਈ ਫ੍ਰਿਜ ਵਗੈਰਾ ਹੈਗਾ ਘਰ ਘਰ ਏ ਸੀ ਹੈਗਾ ਕਹਿਣ ਦਾ ਮਤਲਬ ਕੀ ਹੈਗਾ ਸ ਮ ਮੈਂ ਜਿਹੜੀ ਪਾਵਰ ਆ ਉਹਨੂੰ ਘਟਾ ਦਿੱਤਾ ਲੋਕਾਂ ਨੂੰ ਇੰਨੇ ਵਿਹਲੇ ਕਰਤਾ ਤੈਕਨੋਲਜੀ ਨੇ ਕਿ ਉਹਨਾਂ ਦਾ ਜੀਵਨ ਸੌਖਾ ਤਾਂ ਕਰ ਹੀ ਦਿੱਤਾ ਨਾਲ ਨਾਲ ਕੁਛ ਚੀਜ਼ਾਂ ਉਹਨਾਂ ਨੂੰ ਦਿੱਕਤਾਂ ਆਉਣ ਲੱਗ ਜਾਂਦੀਆਂ ਨੇ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਤੈਕਨੋਲੋਜੀ ਨੇ ਜਿਹੜਾ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਆਸਾਨ ਬਣਾਇਆ ਹੈਗਾ ਨਵੀਆਂ ਤੋਂ ਨਵੀਆਂ ਜਿਹੜੀਆਂ ਦਵਾਈਆਂ ਦੀਆਂ ਮੈਡੀਸਨ ਦੀ ਖੋਜ ਹੋ ਰਹੀ ਹੈ ਨਵੇਂ ਨਵੇਂ ਆਪਰੇਸ਼ਨਾਂ ਦੀ ਖੋਜ ਹੋ ਰਹੀ ਹੈ ਪਹਿਲਾਂ ਬੰਦਾ ਦਵਾਈਆਂ ਦੀ ਘਾਟ ਦੇ ਕਾਰਨ ਮਰ ਹੀ ਜਾਂਦਾ ਸੀ ਪਰ ਡਾਕਟਰ ਕੀ ਹੈਗਾ ਅੱਜ ਮਰੇ ਹੋਏ ਬੰਦੇ 'ਚ ਵੀ ਜਾਨ ਪਾ ਦਿੰਦਾ ਇਹ ਸਾਰਾ ਕੁਝ ਤੈਕਨੋਲਜੀ ਦੇ ਕਾਰਨ ਹੀ ਹੈਗਾ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਤੈਕਨੋਲੋਜੀ ਨੇ ਜ਼ਿੰਦਗੀ ਨੂੰ ਕਿੰਨਾ ਸੌਖਾ ਆਸਾਨ ਬਣਾਇਆ ਹੋਇਆ ਹੈ ਧੰਨਵਾਦ